ਹੈਲੋ ਹਾਂਜੀ ਬੇਟੇ ਦੀ ਐਡਮਿਸ਼ਨ ਕਰਵਾਉਣੀ ਸੀ ਨਾ ਅਤੇ ਫਿਰ ਸੋਚ ਲਈਏ ਪਹਿਲਾਂ ਸਲਾਹ ਕਰ ਲਈਏ ਕਿਹੜੇ ਕਿਹੜੇ ਸਕੂਲ 'ਚ ਕਰਵਾ ਸਕਦੇ ਹਾਂ ਸਕੂਲ ਪਹਿਲਾਂ ਤਾਂ ਦੇਖੀਏ ਕਿਹੜੇ ਕਿਹੜੇ ਹੈਗੇ ਨੇ ਬੱਚਾ ਤਾਂ ਛੋਟਾ ਹੀ ਹੈ ਨਾ ਡਿਸਾਈਡ ਉਹਨੇ ਤਾਂ ਨਹੀਂ ਕਰਨਾ ਨਾ ਸਕੂਲ ਹਾਂ ਹੋਲੀ ਹਾਰਟ ਹੈ ਹਾਂ ਕੋਂਨਵੈਂਟ ਹੈ ਕੋਂਨਵੈਂਟ ਹੈ ਹਾਂਜੀ ਹਾਂਜੀ ਕੋਂਨਵੈਂਟ ਸਕੂਲ

ਆਰਮੀ ਸਕੂਲ ਅੱਛਾ ਅੱਛਾ ਉਹ ਬਾਹਰ ਜਾ ਕੇ ਜਿਹੜਾ ਹਾਂ ਰਾਮਪੁਰਾ ਦੇ ਕੋਲ ਹੁੰ ਅੱਛਾ ਅਤੇ ਅੱਛਾ ਹਾਂ ਹਾਂ ਅੱਛਾ ਚੱਲੋ ਇਹ ਵੀ ਦੇਖਣਾ ਹੀ ਪੈਂਦਾ ਵੀ ਬਾਹਰ ਬਾਅਦ ਵਿੱਚ ਬੱਚੇ ਵਾਸਤੇ ਕਿਹੜਾ ਹੈਲਪਫੁਲ ਰਹੇਗਾ ਨੌਕਰੀ ਦਾ ਤਾਂ ਸੋਚਣਾ ਹੀ ਪਵੇਗਾ ਨਾ ਅਤੇ ਜੇ ਉਹ ਠੀਕ ਹੈਗਾ ਤਾਂ ਫਿਰ ਚੱਲੋ ਬੀ ਐਸ ਐਫ ਸੋਚ ਸਕਦੇ ਹਾਂ ਚੱਲੋ ਬੀ ਐਸ ਐਫ ਨੰਬਰ ਇੱਕ 'ਤੇ ਨੰਬਰ ਇੱਕ 'ਤੇ ਬੀ ਐਸ ਐਫ ਅਤੇ ਜੇ ਉਹਦੇ 'ਚ ਕੋਈ ਗੱਲ ਹੋਈ ਤਾਂ ਸੈਕਿੰਡ ਕਿਹੜਾ ਹੋਇਆ ਫਿਰ ਅੱਛਾ ਨਵੋਦਿਆ ਦੇ ਵੀ ਅੱਛੇ ਹੁੰਦੇ ਸਕੂਲ ਤਾਂ ਅੱਛਾ ਅੱਛਾ ਅੱਛਾ ਹਾਂ ਹਾਂ ਹਾਂ ਚੱਲੋ ਡਿਸਾਈਡ ਕਰਦੇ ਹਾਂ ਫਿਰ ਹਾਂ ਠੀਕ ਹੈ ਜੀ ਠੀਕ ਹੈ ਓਕੇ